ਮੈਂ ਭਿੰਡੀ ਦੀ ਸਬਜ਼ੀ ਬਣਾਉਣ ਲਈ ਸਭ ਤੋਂ ਪਹਿਲਾਂ ਤਾਜ਼ੀ ਭਿੰਡੀ ਤੋੜੀ ਜੋ ਕਿ ਮੈਂ ਆਪਣੇ ਗਮਲਿਆਂ ਵਿੱਚ ਬੀਜੀ ਹੋਈ ਹੈ ਕਿਉਂਕਿ ਬਜ਼ਾਰੋਂ ਖਰੀਦੀ ਸਬਜ਼ੀ ਕਈ ਵਾਰ ਤਾਜ਼ੀ ਨਹੀਂ ਮਿਲਦੀ ਅਤੇ ਘਰ ਵਿੱਚ ਬੀਜੀ ਸਬਜ਼ੀ ਬਜ਼ਾਰੂ ਸਬਜ਼ੀਆਂ ਨਾਲੋਂ ਸਿਹਤ ਲਈ ਲਾਭਦਾਇਕ ਅਤੇ ਖਾਣ ਵਿੱਚ ਵੀ ਸਵਾਦ ਬਣਦੀ ਹੈ ਇਸ ਲਈ ਮੈਂ ਅਕਸਰ ਹੀ ਸਬਜ਼ੀ ਆਪਣੇ ਘਰ ਵਿੱਚ ਗਮਲਿਆਂ ਵਿੱਚ ਬੀਜਦਾ ਹਾਂ ਭਿੰਡੀ ਤੋੜਨ ਲਈ ਹੱਥਾਂ ਉੱਪਰ ਦਸਤਾਨੇ ਚੜ੍ਹਾਉਣੇ ਪੈਂਦੇ ਹਨ ਕਿਉਂਕਿ ਇਸ ਵਿੱਚ ਕੰਡ ਬਹੁਤ ਜ਼ਿਆਦਾ ਹੁੰਦੀ ਹੈ ਮੈਂ ਭਿੰਡੀ ਤੋੜ ਕੇ ਸਭ ਤੋਂ ਪਹਿਲਾਂ ਉਸਨੂੰ ਧੋਇਆ ਕਿਉਂਕਿ ਤੁਹਾਨੂੰ ਪਤਾ ਹੀ ਹੋਵੇਗਾ ਕਿ ਭਿੰਡੀ ਨੂੰ ਕੱਟ ਕੇ ਧੋਇਆ ਨਹੀਂ ਜਾ ਸਕਦਾ ਫਿਰ ਭਿੰਡੀ ਨੂੰ ਧੋਣ ਤੋਂ ਬਾਅਦ ਉਸ ਨੂੰ ਕੱਟ ਲਵੋ ਇੱਕ ਪਿਆਜ ਕੱਟ ਲਵੋ ਅਤੇ ਥੋੜ੍ਹਾ ਜਿਹਾ ਲਸਣ ਕੁੱਟ ਲਓ ਜਾਂ ਮਿਕਸੀ ਵਿੱਚ ਪੇਸਟ ਬਣਾ ਲਵੋ ਫਿਰ ਕੜਾਹੀ ਵਿੱਚ ਇਕ ਕੜਛੀ ਤੇਲ ਪਾਓ ਉਸ ਵਿੱਚ ਪਿਆਜ ਅਤੇ ਲਸਣ ਨੂੰ ਭੁੰਨੋ ਫ਼ਿਰ ਸਵਾਦ ਅਨੁਸਾਰ ਮਸਾਲੇ ਪਾਓ ਫਿਰ ਉਸ ਵਿੱਚ ਭਿੰਡੀ ਰਲਾ ਦਿਓ ਉਸ ਵਿੱਚ ਥੋੜ੍ਹਾ ਜਿਹਾ ਨਿੰਬੂ ਨਿਚੋੜ ਦਿਓ ਕਿਉਂਕਿ ਅਜਿਹਾ ਕਰਨਾ ਭਿੰਡੀ ਵਿੱਚ ਜਾਲਾ ਨਹੀਂ ਬਣੇਗਾ ਅਤੇ ਖਾਣ ਵਿੱਚ ਵੀ ਸਵਾਦ ਬਣੇਗੀ